ਯੋਗਾ ਸਾਨੂੰ ਸਰੀਰਕ ਅਤੇ ਮਾਨਸਿਕ ਦੋਵੇਂ ਤਰੀਕੇ ਦੇ ਨਾਲ ਜੋ ਹੈ ਉਹ ਵਿਕਾਸ ਕਰਦਾ ਹੈ ਆਹ ਤੁਹਾਡਾ ਸਰੀਰ ਹੀ ਨਹੀਂ ਬਲਕਿ ਤੁਹਾਡਾ ਦਿਮਾਗ ਵੀ ਯੋਗ ਕਰਨ ਨਾਲ ਸ਼ਾਂਤ ਹੁੰਦਾ ਅਤੇ ਉਹਦਾ ਇੱਕ ਅਲੱਗ ਹੀ ਤਰੀਕੇ ਨਾਲ ਵਿਕਾਸ ਹੁੰਦਾ ਜਦੋਂ ਸਾਡਾ ਸਰੀਰ ਅਤੇ ਸਾਡਾ ਦਿਮਾਗ ਦੋਵੇਂ ਹੀ ਸ਼ਾਂਤ ਰਹਿੰਦੇ ਆ ਅਤੇ ਸਾਡਾ ਆਪਣੇ ਆਪ ਹੀ ਇਹਦੇ ਲਗਾਤਾਰ ਅਭਿਆਸ ਨਾਲ ਵਿਅਕਤੀਗਤ ਵਿਕਾਸ ਵੀ ਹੁੰਦਾ ਹੈ ਅਸੀਂ ਬਹੁਤ ਬਰੋਡ ਸੋਚਦੇ ਹਾਂ ਮੈਡੀਟੇਸ਼ਨ ਇੱਕ ਇੱਦਾਂ ਦਾ ਕਹਿੰਦੇ ਆ ਰਸਤਾ ਹੈ ਜਿਸ ਦੇ ਜ਼ਰੀਏ ਅਸੀਂ ਖੁਦ ਵੀ ਭਾਲ ਕਰ ਸਕਦੇ ਹਾਂ ਖੁਦ ਨੂੰ ਸ਼ਾਂਤ ਕਰ ਸਕਦੇ ਹਾਂ ਜਦੋਂ ਅਸੀਂ ਖੁਦ ਨੂੰ ਸ਼ਾਂਤ ਕਰਦੇ ਹਾਂ ਖੁਦ ਦੀ ਭਾਲ ਕਰਦੇ ਹਾਂ ਜਾਂ ਕਾਮ ਹੋ ਜਾਂਦੇ ਹਾਂ ਤਾਂ ਵਿਅਕਤੀਗਤ ਵਿਕਾਸ ਆਪਣੇ ਆਪ ਹੀ ਹੋਣਾ ਲੱਗ ਪੈਂਦਾ ਅਤੇ ਅਸੀਂ ਦੂਸਰਿਆਂ ਨੂੰ ਵੀ ਉਹ ਹੀ ਪੋਜੀਟਿਵ ਐਨਰਜੀ ਜਿਹੜੀ ਹੈਗੀ ਹੈ ਦਿੰਦੇ ਹਾਂ ਸਵੈ ਖੋਜ ਦੀ ਸਹੂਲਤ ਪ੍ਰਦਾਨ ਕਰ ਸਕਦਾ ਹੈ ਹਾਂ ਇਹ ਸਵੈ ਖੋਜ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ ਕਿਉਂਕਿ ਇਸ ਤੋਂ ਬਾਅਦ ਅਸੀਂ ਆਪਣੇ ਬਾਰੇ ਸੋਚਦੇ ਹਾਂ ਅੱਜ ਕੱਲ੍ਹ ਅਸੀਂ ਇੰਨੇ ਬਿਜ਼ੀ ਹੋ ਗਏ ਹਾਂ ਕਿ ਅਸੀਂ ਸਿਰਫ ਬਿਜ਼ੀ ਸ਼ਡਿਊਲ ਦੇ ਵਿੱਚ ਆਪਣੇ ਕੰਮ ਕਾਜਾਂ ਨੂੰ ਹੀ ਕਰ ਰਹੇ ਹਾਂ ਆਪਣੇ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ ਲੇਕਿਨ ਜਦੋਂ ਅਸੀਂ ਯੋਗ ਕਰਦੇ ਹਾਂ ਤਾਂ ਸਾਡਾ ਪੂਰਾ ਫੋਕਸ ਸਾਡੇ ਆਪਣੇ ਉੱਤੇ ਹੁੰਦਾ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਕੌਣ ਹਾਂ ਅਸੀਂ ਆਪਣੇ ਆਪ ਨੂੰ ਕਿਵੇਂ ਹੈਲਦੀ ਰੱਖਣਾ ਜਦੋਂ ਅਸੀਂ ਅ ਯੋਗ ਦੇ ਜ਼ਰੀਏ ਆਪਣੀ ਹੈਲਥ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਆਪਣੇ ਆਪ ਹੀ ਵਿਅਕਤੀਗਤ ਵਿਕਾਸ ਅਤੇ ਸਵੈ ਖੋਜ ਦੀ ਸਹੂਲਤ ਦੋਵੇਂ ਹੀ ਪ੍ਰਦਾਨ ਹੋ ਜਾਂਦੀਆਂ ਹਨ